ਕੁਝ ਸਥਾਨਕ ਰਿਹਾਇਸ਼ੀ ਵਿਕਲਪ ਅਧਾਰਤ ਹੈ ਕਿ ਜਿਸ ਜਗ੍ਹਾ ਤੋਂ ਲੋਕ ਜਿਸ ਲੋਕ ਆਪਣੇ ਘਰਾਂ ਤੋਂ ਆ ਕੇ ਕਿਸੇ ਹੋਰ ਜਗ੍ਹਾ 'ਤੇ ਆ ਕੇ ਰਹਿੰਦੇ ਹਨ ਰੈਂਟ ਦੇ ਉੱਤੇ ਰੂਪਨਗਰ ਦੇ ਵਿੱਚ ਕਈ ਸਥਾਨਕ ਰਿਹਾਇਸ਼ੀ ਵਿਕਲਪ ਉਪਲਬਧ ਹਨ ਜਿਵੇਂ ਸਨਸਿਟੀ ਦੇ ਵਿੱਚ ਕਾਫੀ ਰੂਮਸ ਅਵੇਲੇਬਲ ਹਨ ਜੋ ਕਿ ਅ ਜਿਸ ਨੂੰ ਕਿ ਕਈ ਪ੍ਰਕਾਰ ਦੇ ਵਿਅਕਤੀ ਲੈ ਸਕਦੇ ਹਨ ਇਹਨਾਂ ਦਾ ਕਿਰਾਇਆ ਲਗਭਗ ਛੇ ਤੋਂ ਬਾਰਾਂ ਹਜ਼ਾਰ ਦੇ ਵਿੱਚ ਹੈ ਇਸ ਇਸ ਵਿੱਚ ਰੂਮ ਦੇ ਵਿੱਚ ਹੀ ਵਾਸ਼ਰੂਮ ਸਭ ਕੁਝ ਮਿਲ ਜਾਂਦਾ ਹੈ ਰਸੋਈ ਵਗੈਰਾ ਮਿਲ ਜਾਂਦਾ ਹੈ ਇਸ ਦਾ ਫਾਇਦਾ ਇਹ ਹੈ ਕਿ ਬਾਹਰ ਦੇ ਬਾਹਰ ਤੋਂ ਜੋ ਲੋਕ ਆਉਂਦੇ ਹਨ ਸਾਡੇ ਸੌ ਰੋਪੜ ਦੇ ਵਿੱਚ ਰਹਿਣ ਜਾਂ ਫਿਰ ਪੜ੍ਹਨ ਰੋਪੜ ਦੇ ਵਿੱਚ ਘੁੰਮਣ ਉਹਨਾਂ ਨੂੰ ਰੈਂਟ 'ਤੇ ਕਰੇ ਰੈਂਟ 'ਤੇ ਰੂਮ ਮਿਲ ਜਾਂਦਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਹੋਟਲਸ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਜੋ ਵਿਦਿਆਰਥੀ ਉਰੇ ਪੜ੍ਹਨ ਆਉਂਦੇ ਹਨ ਉਨ੍ਹਾਂ ਨੂੰ ਆਸਾਨੀ ਮਿਲਦੀ ਹੈ ਉਹ ਆਪਣਾ ਆਰਾਮ ਨਾਲ ਆ ਕੇ ਉਰੇ ਰਹਿ ਸਕਦੇ ਹਨ ਅਤੇ ਆਪਣੀ ਸਿੱਖਿਆ ਨੂੰ ਪੂਰਾ ਕਰ ਸਕਦੇ ਹਨ